ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਤੁਹਾਨੂੰ ਪਤਾ ਜਦੋਂ ਲੋਕਡਾਊਨ ਲੱਗ ਗਿਆ ਸੀ ਤਾਂ ਸਾਰਾ ਕੁਛ ਬੰਦ ਹੋ ਗਿਆ ਸੀਗਾ ਘਰ ਬੈਠ ਕੇ ਵੀ ਨਹੀਂ ਸਰਦਾ ਸੀਗਾ ਕੰਮ ਕਰਨ ਲਈ ਬਾਹਰ ਨਹੀਂ ਜਾਣਾ ਪੈਂਦਾ ਸੀਗਾ ਅਤੇ ਬਹੁਤ ਦਿੱਕਤ ਪਰੇਸ਼ਾਨੀ ਆਉਣ ਲੱਗ ਗਈ ਸੀ ਲੋਕਡਾਊਨ ਵਿੱਚ ਮੈਂ ਘਰ ਬੈਠੇ ਨੇ ਮੋਬਾਈਲ ਫੋਨ ਔਨਲਾਈਨ ਆਡਰ ਕੀਤਾ ਜੋ ਕਿ ਚਾਰ ਤੋਂ ਪੰਜ ਦਿਨਾਂ ਵਿੱਚ ਸਾਡੇ ਘਰ ਆ ਗਿਆ ਸਾਡਾ ਕੰਮਕਾਰ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਲੋਕਡਾਊਨ ਵਿੱਚ ਘਰ ਤੋਂ ਬਾਹਰ ਕੰਮ ਕਰ ਲਈ ਨਹੀਂ ਜਾ ਸਕਦੇ ਸੀ ਇਸ ਕਰਕੇ ਮੈਂ ਮੋਬਾਈਲ ਫੋਨ ਮੰਗਵਾਇਆ ਔਨਲਾਈਨ ਐਮਾਜ਼ੋਨ ਤੋਂ ਆਡਰ ਕੀਤਾ ਸੀ ਫੋਨ ਸਾਡੇ ਘਰ ਆ ਗਿਆ ਇਸ ਨਾਲ ਮੈਨੂੰ ਬਹੁਤ ਹੀ ਸੌਖਾ ਹੋਰ ਹੋ ਗਿਆ ਨਾਲ ਨਾਲ ਮੇਰੇ ਕਾਮ ਬੱਚਿਆਂ ਨੂੰ ਵੀ ਸੌਖਾ ਹੋ ਗਿਆ ਕਿਉਂਕਿ ਮੈਂ ਤਾਂ ਔਨਲਾਈਨ ਕੰਮ ਕਰਦਾ ਸੀਗਾ ਕੰਪਨੀ ਵਿੱਚ ਅਤੇ ਮੈਨੂੰ ਪੇਮੈਂਟ ਔਨਲਾਈਨ ਆ ਜਾਂਦੀ ਸੀ ਅਤੇ ਬੱਚਿਆਂ ਨੂੰ ਵੀ ਸੌਖਾ ਹੋ ਗਿਆ ਕਿਉਂ ਕਰਕੇ ਉਹਨਾਂ ਦੀਆਂ ਪੜ੍ਹਾਈ ਸਕੂਲ ਵਿੱਚ ਜਾ ਨਹੀਂ ਸਕਦੇ ਸੀਗੇ ਅਤੇ ਕਲਾਸਾਂ ਲਾਉਣੀਆਂ ਹੁੰਦੀਆਂ ਸੀਗੀਆਂ ਉਹ ਘਰ ਬੈਠੇ ਹੀ ਔਨਲਾਈਨ ਕਲਾਸਾਂ ਲਾਉਣ ਲੱਗ ਪਏ ਅਤੇ ਪਰ ਬੱਚੇ ਪੜ੍ਹਦੇ ਰਹੇ ਪੜ੍ਹਣ ਤੋਂ ਬਾਅਦ ਉਹ ਫੋਨ 'ਤੇ ਗੇਮਾਂ ਖੇਲ ਲੈਂਦੇ ਵੀਡੀਓਜ਼ ਦੇਖ ਲੈਂਦੇ ਅਤੇ ਬਹੁਤ ਹੀ ਇਹ ਮੇਰਾ ਬਹੁਤ ਹੀ ਪੋਜ਼ੀਟਿਵ ਐਕਸਪੀਰੀਅੰਸ ਸੀ ਮੈਨੂੰ ਬਹੁਤ ਵਧੀਆ ਲੱਗਿਆ ਜਿਹੜਾ ਲੋਕਡਾਊਨ ਵਿੱਚ ਮੋਬਾਇਲ ਫੋਨ ਸਾਡੇ ਘਰ ਆ ਗਿਆ